ਪੰਜਾਬ ਦੇ ਵਿੱਚ ਹੈਲਥ ਕੇਅਰ ਡੇਟਾ ਅਤੇ ਜਾਣਕਾਰੀ ਹੈ ਜਿਹੜੀ ਇਹਨੂੰ ਅੱਜ ਕੱਲ੍ਹ ਆਪਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਦੇਖੀਏ ਤਾਂ ਬਹੁਤ ਸਾਰੀਆਂ ਇੱਦਾਂ ਡਾਟਾ ਸ਼ੀਟਸ ਬਣੀਆਂ ਹੋਈਆਂ ਨੇ ਜਾਂ ਆਪਣੇ ਕੰਪਿਊਟਰਾਂ ਦੇ ਉੱਤੇ ਐਪਸ ਵੀ ਬਹੁਤ ਸਾਰੀਆਂ ਨੇ ਜਿਹਦੇ ਵਿੱਚ ਉਹ ਸਾਰਾ ਡਾਟਾ ਕੀ ਹੈ ਇਕ ਇਕੱਤਰ ਕਰ ਲੈਂਦੇ ਨੇ ਅਤੇ ਹੁਣ ਆਪਾਂ ਜਿੱਦਾਂ ਕੋਵਿਡ ਦੇ ਵਿੱਚ ਵੀ ਜੇ ਆਪਾਂ ਜੇਕਰ ਗੱਲ ਕਰੀਏ ਆਪਾਂ ਨੂੰ ਆਨਲਾਈਨ ਐਪ ਦੇ ਜ਼ਰੀਏ ਸਾਰਾ ਪਤਾ ਹੁੰਦਾ ਸੀਗਾ ਵੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਆਪਣੇ ਇੰਨੇ ਕੋਵਿਡ ਦੇ ਮਰੀਜ਼ ਹੈਗੇ ਨੇ ਤਾਂ ਕਰਕੇ ਕਿਤੇ ਨਾ ਕਿਤੇ ਬਹੁਤ ਇਹ ਆਨਲਾਈਨ ਐਪਸ ਦੀ ਮਦਦ ਦੇ ਨਾਲ ਬਹੁਤ ਸੁਖਾਲਾ ਹੋ ਗਿਆ ਹੈ ਨਾ ਇਹ ਚੀਜ਼ਾਂ ਨੂੰ ਦੇਖਣਾ ਤਾਂ ਬਾਕੀ ਕੀ ਆ ਆਪਾਂ ਇਹਦੇ ਵਿੱਚ ਕਹਿੰਦੇ ਇਹਨੂੰ ਬਿਹਤਰ ਬਣਾਉਣ ਲਈ ਆਪਾਂ ਕੀ ਕਰ ਸਕਦੇ ਹਾਂ ਜਿੱਦਾਂ ਹੁਣ ਕਈ ਪ੍ਰਾਈਵੇਟ ਹੋਸਪਿਟਲ ਹੈਗੇ ਨੇ ਸਰਕਾਰੀ ਹੋਸਪੀਟਲ ਹੈਗੇ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਇੰਟੀਗਰੇਟਡ ਹੋ ਜਾਣ ਮਤਲਬ ਜਿਹੜਾ ਆਪਣੇ ਕੋਲ ਡਾਟਾ ਸਾਰਾ ਇੱਕ ਆਨਲਾਈਨ ਕੋਈ ਪੋਰਟਲ ਇੱਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰਾ ਇਹ ਡਾਟਾ ਕੰਬਾਈਨ ਹੋਵੇ ਸਾਰੀ ਆਪਾਂ ਨੂੰ ਇਨਫੋਰਮੇਸ਼ਨ ਉੱਥੇ ਮਿਲੇ ਜਿੱਦਾਂ ਹੁਣ ਕਈ ਅੱਜ ਕੱਲ੍ਹ ਪ੍ਰਾਈਵੇਟ ਕਈ ਚੰਗੇ ਹੋਸਪਿਟਲ ਨੇ ਜਿਹੜੇ ਮਤਲਬ ਆਨਲਾਈਨ ਹੀ ਆਪਾਂ ਨੂੰ ਸਾਰੀਆਂ ਰਿਪੋਰਟਸ ਮਿਲ ਜਾਂਦੀਆਂ ਨੇ ਤਾਂ ਉਹਦੇ ਨਾਲ ਕੀ ਹੈ ਬਹੁਤ ਸਮਾਂ ਬਚ ਜਾਂਦਾ ਆਪਣਾ ਤਾਂ ਕਰਕੇ ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਜਿਹਦੇ ਨਾਲ ਆਪਾਂ ਇਹ ਜਿਹੜੀ ਆਪਣੀ ਸਿਹਤ ਸੰਭਾਲ ਸਿੱਖਿਆ ਪ੍ਰਣਾਲੀ ਹੈ ਇਹਨੂੰ ਥੋੜ੍ਹਾ ਬਿਹਤਰ ਬਣਾ ਸਕਦੇ ਹਾਂ